ਮੈਂ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਤਾਂ ਜਿਵੇਂ ਕਿ ਪਹਿਲਾਂ ਮੈਂ ਗੱਲ ਕੀਤੀ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਛੋਟੇ ਬੱਚੇ ਜ਼ਿਆਦਾਤਰ ਬਾਹਰ ਵਾਲੀਆਂ ਗੇਮਾਂ ਖੇਡਦੇ ਸਨ ਪਰ ਅੱਜ ਕੱਲ੍ਹ ਦੇ ਬੱਚੇ ਮੋਬਾਇਲ ਵਾਲੀਆਂ ਗੇਮਾਂ ਜ਼ਿਆਦਾ ਪਸੰਦ ਕਰਦੇ ਹਨ ਫੇਰ ਵੀਡੀਓ ਗੇਮਾਂ ਗੇਮ ਮੈਨੂੰ ਇਸ ਇਹਨਾਂ ਬਾਰਿਆਂ ਜ਼ਿਆਦਾ ਤਾਂ ਨਹੀਂ ਪਤਾ ਕਿ ਮੈਂ ਸੁਣਿਆ ਹੈ ਕਿ ਅੱਜ ਕੱਲ੍ਹ ਦੇ ਬੱਚੇ ਪਬਜੀ ਫ੍ਰੀ ਫਾਇਰ ਕਾਰ ਰੇਸਿੰਗ ਵਾਲੀਆਂ ਗੇਮਾਂ ਬਹੁਤ ਜ਼ਿਆਦਾ ਖੇਡਦੇ ਹਨ ਅਤੇ ਕਈ ਲੋਕ ਫੋਨ ਵਿੱਚ ਲੂਡੋ ਵੀ ਖੇਡਦੇ ਹਨ ਜਿਹਨਾਂ ਗੇਮਾਂ ਖੇਡਣ ਲਈ ਸਾਨੂੰ ਇੰਟਰਨੈੱਟ ਆਦਿ ਦੀ ਜ਼ਰੂਰਤ ਪੈਂਦੀ ਹੈ ਜਿਸ ਕਰਕੇ ਸਾਨੂੰ ਮਹਿੰਗੇ ਮਹਿੰਗੇ ਰਿਚਾਰਜ ਕਰਵਾਉਣੇ ਕਰਵਾਉਣ ਦੀ ਲੋੜ ਪੈਂਦੀ ਹੈ ਇਹ ਇਹ ਗੇਮਾਂ ਜ਼ਿਆਦਾਤਰ ਖੇਡਦੇ ਬੱਚਿਆਂ ਨੂੰ ਇਸ ਦੀ ਆਦਤ ਵੀ ਲੱਗ ਜਾਂਦੀ ਹੈ ਅਤੇ ਜਿਵੇਂ ਮੈਂ ਦੱਸਿਆ ਹੈ ਕਿ ਸਾਰੀਆਂ ਗੇਮਾਂ ਫੋਨ ਵਿੱਚ ਖੇਡੀਆਂ ਜਾਂਦੀਆਂ ਹਨ ਸਾਨੂੰ ਪਤਾ ਹੈ ਕਿ ਫੋਨ ਦੇ ਕਈ ਨੁਕਸਾਨ ਹਨ ਜਿਵੇਂ ਕਿ ਉਹ ਅੱਖਾਂ ਨੂੰ ਖ਼ਰਾਬ ਕਰਦਾ ਹੈ ਅਤੇ ਉਸਦੇ ਕਾਫੀ ਸਾਰੇ ਹੋਰ ਵੀ ਨੁਕਸਾਨ ਹਨ ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਫੋਨ ਵਾਲੀਆਂ ਗੇਮਾਂ ਘੱਟ ਤੋਂ ਘੱਟ ਖੇਡਣੀਆਂ ਚਾਹੀਦੀਆਂ ਹਨ ਜ਼ਿਆਦਾਤਰ ਸਾਨੂੰ ਬਾਹਰ ਵਾਲੀਆਂ ਗੇਮਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ